ਮੈਂ ਸਾਈਟਕਾ ਦੇ ਦਰਦ ਤੋਂ ਪਰੇਸ਼ਾਨ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਮੱਸਿਆ ਕਿਵੇਂ ਹੱਲ ਹੋਵੇਗੀ ਬਹੁਤ ਡਾਕਟਰਾਂ ਦੀ ਸਲਾਹ ਲਈ ਪਰ ਕੋਈ ਹੱਲ ਨਹੀਂ ਹੋਇਆ ਫਿਰ ਮੈਨੂੰ ਕਿਸੇ ਨੇ ਯੋਗਾ ਬਾਰੇ ਸਲਾਹ ਦਿੱਤੀ ਮੈਂ ਯੋਗਾ ਕਰਨਾ ਸ਼ੁਰੂ ਕੀਤਾ ਅਤੇ ਦੂਸਰੇ ਦਿਨ ਹੀ ਮੈਨੂੰ ਕੁਛ ਫਰਕ ਮਹਿਸੂਸ ਹੋਣ ਲੱਗਿਆ ਇਸ ਲਈ ਮੈਂ ਰੋਜ਼ਾਨਾ ਅੱਧਾ ਘੰਟਾ ਨਿਕਾਲਦਾ ਸੀ ਅਤੇ ਹੁਣ ਮੈਂ ਲਗ ਭਗ ਪੂਰੀ ਤਰ੍ਹਾਂ ਤੰਦਰੁਸਤ ਹਾਂ ਮੇਰੀ ਸਲਾਹ ਹੈ ਕਿ ਸਾਨੂੰ ਸਾਰਿਆਂ ਨੂੰ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ